ਸਾਡੀ ਪੰਜਾਬੀ ਭਾਸ਼ਾ ਦੀ ਵਰਤੋਂ ਦਿਨ ਬ ਦਿਨ ਘੱਟਦੀ ਜਾ ਰਹੀ ਹੈ ਅਤੇ ਅੱਜ ਦੀ ਜੋ ਨਵੀਂ ਜਨਰੇਸ਼ਨ ਹੈ ਉਹ ਪੰਜਾਬੀ ਭਾਸ਼ਾ ਬੋਲਣ ਲਿਖਣ ਲੱਗੇ ਬਹੁਤ ਹੀ ਸ਼ਰਮਿੰਦਾ ਹੈ ਜਦ ਕਿ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਹੈ ਅਤੇ ਜੋ ਅੱਜ ਸਾਡੇ ਬਜ਼ੁਰਗ ਨੇ ਉਹ ਸਾਰੇ ਅੱਜ ਅੱਜ ਵੀ ਪੰਜਾਬੀ ਭਾਸ਼ਾ ਨੂੰ ਬੋਲਣ ਲਿਖਣ ਦੇ ਵਿੱਚ ਹੀ ਪਹਿਲ ਦਿੰਦੇ ਹਨ ਜੋ ਅੱਜ ਦੀ ਜਨਰੇਸ਼ਨ ਹੈ ਉਹ ਬਹੁਤ ਹੀ ਸ਼ਰਮਿੰਦਾ ਹੈ ਉਨ੍ਹਾਂ ਨੂੰ ਇਵੇਂ ਲੱਗਦਾ ਹੈ ਕਿ ਪੰਜਾਬੀ ਬੋਲਣ ਜਾਂ ਲਿਖਣ ਲੱਗੇ ਸਾਡਾ ਸਟੇਟਸ ਜ਼ਿਆਦਾ ਲੋਅ ਹੋ ਜਾਏਗਾ ਤਾਂ ਪਤਾ ਨਹੀਂ ਕਿਉਂ ਐਵੇਂ ਸੋਚਦੇ ਨੇ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਹੀ ਮਾਂ ਬੋਲ਼ੀ ਹੈ ਸਾਡੀ ਇਵੇਂ ਹੀ ਬਹੁਤ ਜ਼ਿਆਦਾ ਸਾਡੀ ਪੰਜਾਬੀ ਭਾਸ਼ਾ ਘੱਟਦੀ ਜਾ ਰਹੀ ਹੈ ਜੋ ਕਿ ਅੱਜ ਦੀ ਨਵੀਂ ਜਨਰੇਸ਼ਨ ਹੈ ਅੱਜ ਕੱਲ੍ਹ ਦੇ ਬੱਚੇ ਸਾਰੇ ਇੰਗਲਿਸ਼ ਬੋਲਣੀ ਜ਼ਿਆਦਾ ਪਸੰਦ ਕਰਦੇ ਨੇ ਜਾਂ ਹਿੰਦੀ ਬੋਲਣੀ ਪਸੰਦ ਕਰਦੇ ਨੇ